ਹੈਲੋ ਹਾਂਜੀ ਹਾਂਜੀ ਤੁਸੀਂ ਐਡਵੋਕੇਟ ਵਿਨੀਤਾ ਬੋਲ ਰਹੇ ਹੋ ਹਾਂਜੀ ਮੈਂ ਜਸਪ੍ਰੀਤ ਬੋਲ ਰਹੀ ਸੀਗੀ ਅਸੀਂ ਇੱਥੇ ਫਾਜ਼ਿਲਕਾ ਰਹਿੰਦੇ ਹਾਂ ਹਾਂਜੀ ਕਾਲਕਾ ਮੰਦਰ ਦੇ ਕੋਲ ਸਾਡਾ ਘਰ ਹੈਗਾ ਹੈ ਅਤੇ ਨਾ ਤੁਹਾਡੇ ਨਾਲ ਗੱਲ ਕਰਨੀ ਸੀਗੀ ਜ਼ਮੀਨ ਬਾਰੇ ਉਹਨਾਂ ਮੇਰੇ ਬੇ ਮੈਂ ਆਪਦੀ ਜ਼ਮੀਨ ਨਾ ਸਾਡੇ ਪਿੰਡ ਹੈਗੀ ਇੱਥੇ ਘੋੜਿਆਂ ਵਾਲੀ ਪਿੰਡ ਸਾਡੀ ਜ਼ਮੀਨ ਹੈਗੀ ਹੈ ਅਤੇ ਮੈਂ ਆਪ ਦੇ ਵੱਡੇ ਬੇਟੇ ਦੇ ਨਾਮ ਕਰਵਾਉਣੀ ਸੀਗੀ ਅਤੇ ਉਹ ਪਹਿਲਾਂ ਅਸੀਂ ਇੱਕ ਹੋਰ ਐਡਵੋਕੇਟ ਕੀਤਾ ਹੋਇਆ ਸੀਗਾ ਉਹਨੂੰ ਦਿੱਤਾ ਸੀਗਾ ਇਹ ਕੇਸ ਐਡਵੋਕੇਟ ਸੰਧੂ ਸੀਗਾ ਹੈਗਾ ਉਹ ਫਾਜ਼ਿਲਕਾ ਦਾ ਹੀ ਸੀ ਪਰ ਉਹ ਸਾਡੇ ਪੈਸੇ ਲੈ ਕੇ ਫੀਸ ਵੀ ਮੇਰੇ ਤੋਂ ਭਰਵਾ ਲਈ ਅਤੇ ਉਹਨੇ ਪਰ ਸਾਡਾ ਕੰਮ ਵੀ ਨਹੀਂ ਕੀਤਾ ਹਾਂਜੀ ਇਹਨੂੰ ਜੀ ਹੋ ਗਏ ਦੋ ਕੁ ਮਹੀਨੇ ਹੋ ਗਏ ਦੋ ਕੁ ਮਹੀਨੇ ਪਹਿਲਾਂ ਤਾਂ ਅਸੀਂ ਉਹਨੂੰ ਵਾਰ ਵਾਰ ਫੋਨ ਕਰਦੇ ਹਾਂ ਜਾਂ ਜਾਂਦੇ ਆ ਤਾਂ ਉਹ ਆਪਦੇ ਉੱਥੇ ਬੈਠਾ ਨਹੀਂ ਹੁੰਦਾ ਹੈਗਾ ਹਾਂਜੀ ਉਹਨੂੰ ਕੀ ਕਹਿੰਦੇ ਅਸੀਂ ਫੋਨ ਕਰਦੇ ਹਾਂ ਅਤੇ ਉਹ ਫੋਨ ਨਹੀਂ ਚੁੱਕਦਾ ਮਿਲਣ ਜਾਂਦੇ ਹਾਂ ਤਾਂ ਉਹ ਕਹਿ ਦਿੰਦੇ ਹਾਂ ਅੱਜ ਤਾਂ ਸਰ ਆਏ ਨਹੀਂ ਗਏ ਅਤੇ ਐਵੇਂ ਕਰਕੇ ਨਾ ਸਾਡੇ ਇੱਕ ਤਾਂ ਪੈਸੇ ਵੀ ਲੈ ਗਿਆ ਅਤੇ ਸਾਡਾ ਕੰਮ ਵੀ ਨਹੀਂ ਕੀਤਾ ਮੇਰੇ ਬੇ ਵੱਡੇ ਬੱਚੇ ਦੇ ਨਾਮ 'ਤੇ ਕਰਵਾ ਦਿੱਤੀ ਜ਼ਮੀਨ ਉਹ ਵੀ ਨਹੀਂ ਹੋਈ ਅਤੇ ਸਾਡਾ ਤੁਸੀਂ ਇਹ ਕੇਸ ਮਾੜਾ ਜਿਹਾ ਥੋੜ੍ਹਾ ਸੋਲਵ ਕਰਕੇ ਸਾਨੂੰ ਦਿਓ ਬਈ ਮੈਂ ਆਪਦੇ ਬੇਟੇ ਦੇ ਨਾਮ ਕਰਵਾਉਣੀ ਹੈ ਹਾਂਜੀ ਹਾਂਜੀ ਉਹ ਸਾਡੇ ਨਾਲ ਨਾ ਇੱਧਰ ਕੀ ਕਹਿੰਦੇ ਆ ਮੇਰੇ ਭਰਾਵਾਂ ਦਾ ਹੀ ਰੌਲਾ ਚੱਲਦਾ ਪਿਆ ਸੀਗਾ ਇਹ ਤਾਂ ਕਰਕੇ ਮੈਂ ਇਧਰ ਮੈਂ ਉਹ ਸਾਡੀ ਮਤਲਬ ਸਾਡੇ ਘਰ ਘਰਾਂ ਚ ਲੜਾਈ ਹੁੰਦੀ ਹੋ ਗਈ ਸੀ ਜ਼ਮੀਨ ਨੂੰ ਲੈ ਕੇ ਅਤੇ ਉਹ ਤਾਂ ਕਰਕੇ ਮੇਰੇ ਨਾਮ 'ਤੇ ਜਿਹੜਾ ਹਿੱਸਾ ਮੇਰੇ ਨਾਮ ਆਉਂਦਾ ਮੈਂ ਆਪਦੇ ਬੱਚੇ ਦੇ ਨਾਮ ਕਰਵਾਉਣਾ ਚਾਹੁੰਦੀ ਹਾਂ ਬਈ ਕੱਲ੍ਹ ਨੂੰ ਸਾਡੇ ਵਿੱਚ ਹੋਰ ਨਾ ਕੋਈ ਭੇਦ ਭਾਵ ਹੋ ਜੇ ਹੈ ਨਾ ਲੜਾਈ ਹੋ ਜੇ ਹਾਂਜੀ ਹਾਂਜੀ ਇੱਕ ਕਾਗਜ਼ ਵਗੈਰਾ ਮੇਰੇ ਕੋਲ ਸਾਰੇ ਬਣੇ ਹੋਏ ਆ ਤੇ ਤੁਸੀਂ ਕਿੱਥੇ ਬਹਿੰਦੇ ਹੋ ਕਿਹੜੀ ਜਗ੍ਹਾ ਤੁਹਾਡੀ ਹਾਂਜੀ ਹਾਂਜੀ ਤੁਹਾਡਾ ਕਿੰਨਾ ਨੰਬਰ ਚੈਂਬਰ ਹੈਗਾ ਜੀ ਜਿੱਥੇ ਬਹਿੰਦੇ ਹੋ ਅੱਛਾ ਠੀਕ ਹੈ ਜੀ ਤੁਸੀਂ ਮਿਲੋਗੇ ਨਾ ਉਸ ਟਾਈਮ ਅਸੀਂ ਸਵੇਰ ਦੇ ਸਾਢੇ ਕੁ ਗਿਆਰਾਂ ਦਸ ਸਾਢੇ ਕੁ ਗਿਆਰਾਂ ਵਜੇ ਤੱਕ ਆ ਜਾਵਾਂਗੇ ਤੁਹਾਡੇ ਕੋਲ ਅੱਛਾ ਠੀਕ ਹੈ ਜੀ ਫਿਰ ਅਸੀਂ ਤੁਹਾਨੂੰ ਮਿਲਦੇ ਹਾਂ ਹੈ ਠੀਕ ਹੈ ਜੀ